ਪਾਣੀ ਘਾਟ ਇੱਕ ਵਾਰ ਪਈ ਸੀ ਉਦੋਂ ਮੈਂ ਪੰਦਰਾਂ ਕੁ ਸਾਲ ਦਾ ਹੁੰਦਾ ਸੀ ਅਤੇ ਉਦੋਂ ਨਾ ਤਾਂ ਟਿਊਵੈੱਲ ਹੁੰਦੇ ਸੀਗੇ ਨਲਕੇ ਹੀ ਹੁੰਦੇ ਸੀਗੇ ਅਤੇ ਪਾਣੀ ਦਾ ਪੱਧਰ ਘੱਟ ਗਿਆ ਸੀਗਾ ਕਾਫੀ ਨਾਲ ਦੇ ਪਿੰਡਾਂ 'ਚ ਵੀ ਹੋ ਗਿਆ ਸੀਗਾ ਅਤੇ ਉਹ ਘਟਨਾ ਕਰਕੇ ਟਿਊਵੈੱਲ ਪਾਣੀ ਜੋ ਨਲਕੇ ਹੁੰਦੇ ਸੀ ਉਹ ਚੱਕਦੇ ਨਹੀਂ ਸੀਗੇ ਅਤੇ ਫਿਰ ਅਸੀਂ ਕੀ ਕਰਦੇ ਸੀ ਪਿੰਡ ਦੇ ਸਰਪੰਚ ਨੇ ਸਾਰਿਆਂ ਨਾਲ ਸਹਿਮਤੀ ਕਰੀ ਅਤੇ ਅਸੀਂ ਨਾਲ ਦੇ ਸ਼ਹਿਰ ਤੋਂ ਜਾਂਦੇ ਸੀ ਟੈਂਕਰ ਭਰ ਕੇ ਲਿਜਾਂਦੇ ਸੀ ਟੈਂਕਰ ਭਰ ਕੇ ਲੈ ਕੇ ਆਉਂਦੇ ਸੀ ਉਸ ਨੂੰ ਸਾਂਝੀ ਜਗ੍ਹਾ 'ਤੇ ਖੜਾਇਆ ਜਾਂਦਾ ਸੀਗਾ ਅਤੇ ਪਰਾ ਇੱਕ ਘਰ ਨੂੰ ਸਿਰਫ਼ ਇੱਕ ਬਾਲਟੀ ਦੀ ਪਾਣੀ ਦੀ ਦਿੱਤੀ ਜਾਂਦੀ ਸੀ ਜਿਸ ਵਿੱਚ ਉਹ ਪੂਰੇ ਦਿਨ ਨਾਲ ਗੁਜ਼ਾਰਾ ਕਰਦਾ ਸੀ ਇਕ ਬਾਲਟੀ ਨਾਲ ਪੂਰਾ ਦਿਨ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀਗਾ ਉਸ ਟਾਈਮ ਦੇ ਵਿੱਚ ਨਹਾਉਣ ਨੂੰ ਵੀ ਬਹੁਤ ਜ਼ਿਆਦਾ ਔਖਾ ਹੋ ਗਿਆ ਸੀ ਨਹਾਉਣ ਦੇ ਵੀ ਹਫ਼ਤੇ ਦੇ ਵਿੱਚ ਕਦੇ ਕਦੇ ਨਹਾਉਣਾ ਤਾਂ ਕਰਕੇ ਅਤੇ ਹੋਰ ਫਰਕ ਪਿਆ ਪਰ ਜਿੰਦਗੀ 'ਚ ਸੌਕਾ ਜਮੀ ਪੈ ਗਿਆ ਸੀਗਾ ਫਸਲਾਂ ਦਾ ਜਮਾਂ ਹੀ ਬੁਰਾ ਹਾਲ ਸੀ ਪਸ਼ੂ ਹੋ ਗਏ ਉਹਨਾਂ ਦਾ ਬੁਰਾ ਹਾਲ ਅਤੇ ਹੋਰ ਇਨਸਾਨ ਦਾ ਤਾਂ ਬੁਰਾ ਹਾਲ ਹੈ ਓ ਕਿਉਂਕਿ ਨਾ ਤਾਂ ਪੀਣ ਨੂੰ ਸੀਗਾ ਪਾਣੀ ਇੱਕ ਪਾਣੀ ਬਾਲਟੀ ਦੀ ਮਿਲਦੀ ਸੀ ਉਹਦੇ ਨਾਲ ਹੀ ਪੀਣ ਦਾ ਕਰਦੇ ਸੀਗੇ ਉਹਦੇ ਨਾਲੇ ਰੋਟੀ ਪਾਣੀ ਸਬਜ਼ੀ ਉਹਦੇ ਨਾਲੇ ਬਣਾਉਣੀ